ਮੇਰਾ ਨਾਮ ਮੋਨੀਕਾ ਹੈ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇਤਿਹਾਸਿਕ ਘਟਨਾਵਾਂ ਬਾਰੇ ਕੁਝ ਗੱਲਾਂ ਦੱਸਣਾ ਚਾਹੁੰਦੀ ਹੈ ਕੁਝ ਥੋੜ੍ਹਾਂ ਸਮਾਂ ਪਹਿਲਾਂ ਸਾਡੇ ਨਾ ਪਿੰਡ ਵਿੱਚ ਨਾ ਬਾਰਿਸ਼ ਜਿਵੇਂ ਕਿ ਮੀਂਹ ਆ ਗਿਆ ਉਸ ਨਾਲ ਬਹੁਤ ਹੀ ਨੁਕਸਾਨ ਹੋਇਆ ਮੀਂਹ ਐਨਾ ਜ਼ਿਆਦਾ ਪਿਆ ਪੰਜ ਛੇ ਦਿਨ ਮਤਲਬ ਹਫਤਾ ਤੋਂ ਵੀ ਉੱਪਰ ਐਨਾ ਜ਼ਿਆਦਾ ਮੀਂਹ ਪਿਆ ਉਸ ਨਾਲ ਸਾਰੇ ਸਾਡੇ ਨਾਲ ਦੀਆਂ ਦਰਿਆਵਾਂ ਟੋਭੇ ਛੱਪੜ ਨਦੀਆਂ ਭਰ ਗਈਆਂ ਐਨਾ ਜ਼ਿਆਦਾ ਭਰਨ ਦੇ ਨਾਲ ਸਾਰਾ ਪਾਣੀ ਬਾਹਰ ਆ ਗਿਆ ਅਤੇ ਸਾਰਿਆਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਅਤੇ ਲੋਕਾਂ ਦੇ ਕਈ ਲੋਕਾਂ ਦੇ ਘਰ ਵੀ ਵਿੱਚੇ ਹੜ੍ਹ ਗਏ ਅਤੇ ਅੱਧਿਆਂ ਦੇ ਘਰ ਟੁੱਟ ਗਏ ਇਸ ਨਾਲ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਤੰਗ ਦਿੱਕਤ ਆਈ ਤੰਗੀ ਆਈ ਮਤਲਬ ਨਾ ਕਿਸੇ ਨੂੰ ਕਿੰਨ ਬ ਲੋਕ ਅੱਜ ਕੱਲ੍ਹ ਉਸ ਸਮੇਂ ਵਿੱਚ ਬਹੁਤ ਲੋਕਾਂ ਨੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਕਿੰਨੇ ਕਿੰਨੇ ਦਿਨ ਬੇਰੁਜ਼ਗਾਰ ਰਹੇ ਭੁੱਖੇ ਰਹੇ ਅਤੇ ਛੋਟੇ ਛੋਟੇ ਬੱਚਿਆਂ ਨੂੰ ਰੋਟੀ ਵੀ ਨਹੀਂ ਨਸੀਬ ਹੋਈ ਅਤੇ ਨਾ ਹੀ ਪਾਣੀ ਮੈਂ ਆਪਣੇ ਘਰ ਦਾ ਆਟਾ ਪਿਹਾ ਕੇ ਲੈ ਕੇ ਆਈ ਅਤੇ ਸਾਡੇ ਘਰ ਵਿੱਚ ਵੀ ਪਾਣੀ ਵੜ ਗਿਆ ਉਹ ਵੀ ਸਾਰਾ ਆਟਾ ਬਾਹਰ ਨਿਕਲ ਗਿਆ ਮਤਲਬ ਵਿੱਚੋਂ ਪਾਣੀ ਅੰਦਰ ਵੜ ਗਿਆ ਸੀਗਾ ਉਸ ਨਾਲ ਹੜ੍ਹ ਕੇ ਬਾਹਰ ਆ ਗਿਆ ਸਾਡਾ ਸਾਰਾ ਆਟਾ ਵੀ ਵਿੱਚ ਡੁੱਬ ਗਿਆ ਅਤੇ ਲੋਕਾਂ ਦੀਆਂ ਫਸਲਾਂ ਵੀ ਬਹੁਤ ਨੁਕਸਾਨ ਹੋਇਆ ਸਾਰਿਆਂ ਦੀਆਂ ਫਸਲਾਂ ਵੀ ਪਾਣੀ ਨਾਲ ਵਹਿ ਗਈਆਂ ਅਤੇ ਸਾਰੇ ਦਰਖਤ ਵੀ ਟੁੱਟ ਗਏ ਅਤੇ ਟੁੱਟ ਕੇ ਗਿਰ ਗਏ ਅਤੇ ਨਾਲ ਹੀ ਸਾਡੀਆਂ ਸਾਰੀਆਂ ਸੜਕਾਂ ਟੁੱਟ ਗਈਆਂ ਇਸ ਨਾਲ ਸਾਨੂੰ ਸਾਰਿਆਂ ਨੂੰ ਆਉਣ ਜਾਣ ਦੇ ਵਿੱਚ ਵੀ ਬਹੁਤ ਨੁਕਸਾਨ ਹੋਇਆ